ਕਿਹਾ ਜਾਂਦਾ ਹੈ ਕਿ ਇਹ ਯੁੱਗ ਧਰਮ ਦਾ ਨਹੀਂ ਵਿਗਿਆਨ ਦਾ ਯੁੱਗ ਅਤੇ ਤਕਨੋਲਜੀ ਦਾ ਯੁੱਗ ਹੈ ਅਤੇ ਹਰ ਤਰਫ਼ ਜਿੱਥੇ ਵੀ ਅਸੀਂ ਦੇਖੀਏ ਸਾਡੀ ਜੇਬ ਤੋਂ ਲੈ ਕੇ ਦੂਰ ਦੂਰ ਤੱਕ ਅਸਮਾਨ ਤੱਕ ਵੀ ਤਕਨੋਲਜੀ ਦੀਆਂ ਹੀ ਸਾਨੂੰ ਉਪਕਰਨ ਮਿਲਦੇ ਹਨ ਅਤੇ ਇਸ ਚੀਜ਼ਾਂ ਤੋਂ ਹ ਮੈਂ ਕੀ ਹਰ ਇੱਕ ਇਨਸਾਨ ਆਕਰਸ਼ਿਤ ਹੁੰਦਾ ਹੈ ਮੈਂ ਜ਼ਿਆਦਾਤਰ ਆਪਣੇ ਫ਼ੋਨ ਤੋਂ ਬਹੁਤ ਆਕਰਸ਼ਿਤ ਹੁੰਦਾ ਹਾਂ ਕਿਉਂਕਿ ਇਸ 'ਤੇ ਆ ਵੱਖ ਵੱਖ ਤਰ੍ਹਾਂ ਦੀਆਂ ਵੱਖ ਵੱਖ ਮੀਨਤਾਵਾਂ ਦੇ ਤਰ੍ਹਾਂ ਦੇ ਸਾਫਟਵੇਅਰ ਸ਼ੋਸ਼ਲ ਮੀਡੀਆ 'ਤੇ ਐਪਸ ਬਣੇ ਹੋਏ ਹਨ ਜਿਨ੍ਹਾਂ 'ਤੇ ਇੰਟਰਟੇਨਮੈਂਟ ਦੇ ਸਾਧਨ ਹਨ ਕਿ ਅਸੀਂ ਇਸ ਨਾਲ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਜੁੜਦੇ ਹਾਂ ਅਤੇ ਮੈਂ ਇਸ ਦੀ ਜਾਣਕਾਰੀ ਜ਼ਿਆਦਾਤਰ ਇੰਟਰਨੈੱਟ ਤੋਂ ਗੂਗਲ 'ਤੇ ਸਰਚ ਕਰਕੇ ਜਾਂ ਕੁਝ ਸਾਡੇ ਰਸਾਲਿਆਂ ਤੋਂ ਮੈਂ ਲੈਂਦਾ ਰਹਿੰਦਾ ਹਾਂ ਕਿਉਂਕਿ ਇਹ ਅੱਜ ਦੇ ਅਜੋਕੇ ਯੁੱਗ ਵਿੱਚ ਬਹੁਤ ਹੀ ਜ਼ਰੂਰੀ ਹੈ ਅਤੇ ਇਸਨੂੰ ਹਾਸਿਲ ਕਰਨ ਨਾਲ ਸਾਡਾ ਇੱਕ ਜੋ ਜਰਨਲ ਨੌਲੇਜ ਦਾ ਇੱਕ ਸਬਜੈਕਟ ਹੈ ਉਹ ਸਾਡਾ ਹਾਇਰ ਹੁੰਦਾ ਰਹਿੰਦਾ ਹੈ ਅਤੇ ਅਸੀਂ ਕਰੰਟ ਅਫੇਅਰ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਜੁੜੇ ਰਹਿੰਦੇ ਹਾਂ